ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਜੀ ਅੱਛਾ ਤੁਸੀਂ ਗੁਰਦਾਸਪੁਰ ਸ਼ਹਿਰ ਤੋਂ ਆਪਣੇ ਅੰਮ੍ਰਿਤਸਰ ਸ਼ਹਿਰ ਜਾਣਾ ਵਾਹਗਾ ਬੋਡਰ ਦੇਖਣ ਠੀਕ ਹੈ ਜੀ ਦੇਖੋ ਜੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਗੱਡੀ ਦਾ ਜਿਹੜਾ ਕਿਰਾਇਆ ਮੈਂ ਟੈਕਸੀ ਬੁੱਕ ਕਰਨੀ ਹੈ ਠੀਕ ਹੈ ਵਧੀਆ ਇਨੋਵਾ ਗੱਡੀ ਆ ਸਮਾਨ ਨਾਲ ਤੁਸੀਂ ਕਿੰਨੇ ਜਾਣੇ ਹੋ ਤੁਸੀਂ ਕਿੰਨੇ ਜਾਣੇ ਹੋ ਐਕਚੁਲੀ ਠੀਕ ਹੈ ਜੀ ਦੇਖੋ ਜੀ ਇਨੋਵਾ ਗੱਡੀ ਇਹ ਅਸੀਂ ਕਰ ਲੈਣੀ ਹੈ ਪੈਂਤੀ ਸੌ ਰੁਪਇਆ ਲੱਗਣਾ ਉਹਦਾ ਅਤੇ ਮੇਰੀ ਜਿਹੜੀ ਫੀਸ ਆ ਉਹਦੇ ਵਿੱਚ ਪੰਦਰਾਂ ਹਜ਼ਾਰ ਪੰਦਰਾਂ ਸੌ ਰੁਪਇਆ ਲੱਗਣਾ ਠੀਕ ਹੈ ਜੀ ਅਤੇ ਕੁਲ ਮਿਲਾ ਕੇ ਇਹੀ ਕੋਈ ਪੰਜ ਹਜ਼ਾਰ ਰੁਪਇਆ ਤੁਹਾਡਾ ਲੱਗਣਾ ਠੀਕ ਹੈ ਅਤੇ ਟੋਟਲ ਇੰਨੇ ਪੈ ਇੰਨੇ ਪੈਸੇ ਲੱਗਣਗੇ ਤਾਂ ਤੁਸੀਂ ਮੈਨੂੰ ਦੱਸ ਦਿਓ ਕਦੋਂ ਜਾਣਾ ਤਾਂ ਮੈਂ ਉਸੇ ਦਿਨ ਤੁਹਾਡੀ ਗੱਡੀ ਕਰ ਲਵਾਂਗਾ ਠੀਕ ਹਾਂਜੀ ਠੀਕ ਹੈ ਜੀ ਠੀਕ ਹੈ ਓਕੇ ਥੈਂਕਯੂ